ਭੰਗੜਾ ਐਰੋਬਿਕਸ ਐਕਚੁਅਲ 'ਚ ਭੰਗੜਾ ਨਹੀਂ ਕਹਿ ਸਕਦੇ ਆਪਾਂ ਉਹਨੂੰ ਭੰਗੜਾ ਤਾਂ ਉਹ ਸੀ ਜੋ ਆਪਣੇ ਪੰਜਾਬ ਦਾ ਐਕਚੁਅਲ ਸੱਭਿਆਚਾਰਕ ਵਿਰਾਸਤ ਦਿਖਾਉਂਦਾ ਸੀ ਭੰਗੜੇ ਦੇ ਜਿਵੇਂ ਬਹੁਤ ਟਾਈਪ ਨੇ ਝੂਮਰ ਲੁੱਡੀ ਧਮਾਲ ਚਿਮਟਾ ਇਹੀ ਅਸਲੀ ਭੰਗੜਾ ਹੈ ਅੱਜ ਕੱਲ ਲੋਕਾਂ ਨੇ ਭੰਗੜਾ ਐਰੋਬਿਕਸ ਸਿੱਖਣਾ ਸ਼ੁਰੂ ਕਰਤਾ ਸ਼ਾਇਦ ਫਿੱਟ ਰਹਿਣ ਲਈ ਸ਼ੁਰੂ ਕਰਤਾ ਪਰ ਉਹਨੂੰ ਐਰੋਬਿਕਸ ਹੀ ਕਿਹਾ ਜਾਵੇ ਤਾਂ ਹੀ ਜ਼ਿਆਦਾ ਚੰਗਾ ਹੈ ਉਹ ਭੰਗੜਾ ਐਰੋਬਿਕਸ ਨਹੀਂ ਹੈ ਜਿੱਦਾਂ ਸਾਡੀ ਯੂਨੀਵਰਸਿਟੀ 'ਚ ਯੂਥ ਫੈਸਟੀਵਲਸ ਹੁੰਦੇ ਹੈ ਤਾਂ ਮੈਂ ਵੀ ਉਹਦੇ 'ਚ ਯੋਗਦਾਨ ਦਿੰਦੀ ਹਾਂ ਮੈਂ ਕਲਚਰਲ ਹੈਡ ਹਾਂ ਤਾਂ ਭੰਗੜੇ ਦੇ ਬਹੁਤ ਪ੍ਰਕਾਰ ਨੇ ਅਤੇ ਅਸਲੀ ਭੰਗੜਾ ਉਹੀ ਭੰਗੜਾ ਹੈ ਜੋ ਅੱਜ ਕੱਲ ਜੋ ਦਿਖਾਉਂਦੇ ਹਾਂ ਆਪਾਂ ਵਿਰਾਸਤ 'ਚ ਦਿਖਾਉਂਦੇ ਹਾਂ ਜੋ ਫਿੱਟ ਰਹਿਣ ਲਈ ਕੀਤਾ ਜਾਂਦਾ ਹੈ ਉਹ ਭੰਗੜਾ ਨਹੀਂ ਹੈ ਕਿਉਂਕਿ ਇੱਕ ਦੋ ਸਟੈਪਸ ਕਰਦੇ ਹੈ ਉਹਨੂੰ ਭੰਗੜਾ ਐਰੋਬਿਕਸ ਕਹਿ ਦਿੰਦੇ ਹੈ ਜੇ ਫਿੱਟ ਰਹਿਣਾ ਤਾਂ ਐਕਚੁਅਲ ਐਕਸਰਸਾਈਜ਼ ਕਰੋ ਭੰਗੜਾ ਐਰੋਬਿਕਸ ਵੱਲ ਕਿਉਂ ਭੰਗੜਾ ਨਾਮ ਐਰੋਬਿਕਸ ਨੂੰ ਦਿੱਤਾ ਜਾਣਾ ਗਲਤ ਹੈ ਬਟ ਠੀਕ ਹੈ ਅੱਜ ਕੱਲ ਚੱਲ ਰਿਹਾ ਫਿੱਟ ਕਿਉਂਕਿ ਲੋਕ ਅੱਜ ਕੱਲ ਦਿਖਾਵੇ 'ਚ ਜ਼ਿਆਦਾ ਜਾ ਰਹੇ ਆ ਫਿੱਟ ਰਹਿਣ ਲਈ ਜ਼ਿਆਦਾ ਜਾ ਰਹੇ ਤਾਂ ਕਹਿੰਦੇ ਹੈ ਜ਼ੁੰਬਾ ਕਲਾਸਿਜ ਲਾ ਲਓ ਜੀ ਭੰਗੜਾ ਲਾ ਲਓ ਜੀ ਤਾਂ ਤੁਸੀਂ ਫਿੱਟ ਰਹੋਗੇ ਪਰ ਭੰਗੜਾ ਇੱਕ ਆਪ ਇੱਕ ਆਪਦੇ ਆਪ 'ਚ ਹੀ ਬੜੀ ਅੱਛੀ ਕਲਚਰਲ ਚੀਜ਼ ਹੈ ਸੱਭਿਆਚਾਰਕ ਚੀਜ਼ ਹੈ ਜੋ ਸਾਡੇ ਵਿਰਸੇ ਨਾਲ ਜੋੜੀ ਰੱਖਦੀ ਹੈ